ਬ੍ਰਹਿਮੰਡ ਦੇ ਵਿੱਚ ਖੋਜ ਨੂੰ ਲੈ ਕੇ ਇਹ ਆ ਵੀ ਜਿਵੇਂ ਕਿ ਆਪਾਂ ਕਹਿ ਦਿੰਦੇ ਹਾਂ ਚੰਦਰਯਾਨ ਮਿਸ਼ਨ ਚੱਲੇ ਆ ਵੀ ਚੰਦਰਯਾਨ ਮਿਸ਼ਨ ਇੱਕ ਦੋ ਤਿੰਨ ਚੱਲੇ ਆ ਅਤੇ ਉਹਦਾ ਵੀ ਸਾਨੂੰ ਆਏਂ ਨਹੀਂ ਪਤਾ ਲੱਗ ਸਕਿਆ ਵੀ ਜਿਹੜਾ ਚੰਦਰਯਾਨ ਮਿਸ਼ਨ ਆ ਜਿਵੇਂ ਕਿ ਕਈ ਲੋਕ ਕਹਿੰਦੇ ਆ ਵੀ ਅਸੀਂ ਚੰਦਰਯਾਨ 'ਤੇ ਉੱਤੇ ਵੀ ਪਲਾਟ ਖਰੀਦ ਲਿਆ ਅਤੇ ਇਹਦੇ ਵਿੱਚ ਇੱਕ ਤਾਂ ਚੰਦਰਯਾਨ 'ਤੇ ਵੀ ਬਹੁਤ ਅਣਸੁਲਝੀਆਂ ਗੱਲਾਂ ਪਈਆਂ ਜਿਹੜੇ ਵਿਸ਼ਿਆਂ 'ਤੇ ਇਹ 'ਤੇ ਵਿਸ਼ਿਆਂ 'ਤੇ ਖੋਜ ਹੋ ਸਕਦੀ ਆ ਇੱਕ ਮੰਗਲ ਗ੍ਰਹਿ ਵੀ ਮੰਗਲ ਗ੍ਰਹਿ 'ਤੇ ਆਪਾਂ ਕਹਿ ਦਿੰਦੇ ਹਾਂ ਵੀ ਇਹ ਏਲੀਅਨ ਹੁੰਦੇ ਇੱਥੇ ਲੋਕ ਰਹਿੰਦੇ ਆ ਇਸ ਵਿਸ਼ੇ 'ਤੇ ਵੀ ਖੋਜ ਹੋ ਸਕਦੀ ਹੈ ਕਿ ਇੱਥੇ ਲੋਕ ਰਹਿੰਦੇ ਵੀ ਹੈ ਵਾਕਏ ਇੱਥੇ ਏਲੀਅਨ ਹੈਗੇ ਹੈ ਕਿ ਨਹੀਂ ਇਹ ਸਾਰੀਆਂ ਅਣਸੁਲਝੀਆਂ ਹੋਈਆਂ ਗੱਲਾਂ ਨੇ ਇੱਕ ਬ੍ਰਹਿਮੰਡ 'ਤੇ ਵੀ ਆਪਾਂ ਦੇਖਦੇ ਹਾਂ ਵੀ ਪਾਣੀ ਵਾਲਾ ਵੀ ਬ੍ਰਹਿਮੰਡ ਦੇ ਵਿੱਚ ਵੀ ਉੱਪਰ ਕਈ ਕਹਿੰਦੇ ਨੇ ਵੀ ਇੱਥੇ ਪਾਣੀ ਹੈਗਾ ਵੀ ਇੱਥੇ ਜਿਉਣਾ ਸੰਭਵ ਹੈ ਜਿਉਣਾ ਸੰਭਵ ਨਹੀਂ ਹੈ ਉਹਨੂੰ ਲੈ ਕੇ ਵੀ ਵੀ ਜਾਂ ਇੱਥੇ ਕੋਈ ਹੋਰ ਮੰਗਲ ਗ੍ਰਹਿ 'ਤੇ ਕੋਈ ਲੋਕ ਰਹਿ ਵੀ ਰਹੇ ਆ ਜਿੱਥੇ ਉਹਨਾਂ ਨੂੰ ਜੀਵਨ ਨਿਰਬਾਹ ਸੌਖਾ ਹੋ ਸਕੇ ਵੀ ਇਹ ਅਣਸੁਲਝੀਆਂ ਹੋਈਆਂ ਗੱਲਾਂ ਨੇ ਜਿਨ੍ਹਾਂ 'ਤੇ ਖੋਜ ਹੋ ਸਕਦੀ ਆ ਅੱਗੇ ਜਾ ਕੇ